ਭਾਰਤ ਦੀਆਂ ਮੁੱਖ ਸਿਆਸੀ ਪਾਰਟੀਆਂ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਮੇਨ ਹੈਗਾ ਕੇਜਰੀਵਾਲ ਔਰ ਅਕਾਲੀ ਦਲ ਜਿਨ੍ਹਾਂ ਦਾ ਮੇਨ ਪ੍ਰਮੁੱਖ ਹੈਗਾ ਸੁਖਬੀਰ ਸਿੰਘ ਬਾਦਲ ਔਰ ਕਾਂਗਰਸ ਜਿਸ 'ਤੇ ਮੁੱਖ ਹੈਗੇ ਆ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਇਸ ਤੋਂ ਇਲਾਵਾ ਭਾਜਪਾ ਜੋ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਦੀ ਪਾਰਟੀ ਹੈ ਔਰ